ਘੋੜ ਸਵਾਰੀ ਕਰਦੇ ਸਮੇਂ ਜਿਹੜਾ ਮੇਰਾ ਅਨੁਭਵ ਹੈ ਉਹ ਮੈਂ ਆਪ ਜੀ ਨਾਲ ਸਾਂਝਾ ਕਰ ਰਿਹਾਂ ਵੀ ਘੋੜ ਸਵਾਰੀ ਕਰਨ ਤੋਂ ਪਹਿਲਾਂ ਘੋੜੇ ਦੇ ਉੱਤੇ ਕਾਠੀ ਜ਼ਰੂਰ ਪਾ ਲੈਣੀ ਚਾਹੀਦੀ ਹੈ ਅਗਰ ਆਪਾਂ ਇਸ ਚੀਜ਼ ਦੀ ਵਰਤੋਂ ਨਹੀਂ ਕਰਦੇ ਤਾਂ ਜਿਹੜੇ ਨਵੇਂ ਘੋੜ ਸਵਾਰ ਨੇ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਪਰੇਸ਼ਾਨੀਆਂ ਦਿੱਕਤ ਘੋੜੇ ਦੇ ਉੱਤੇ ਜਦੋਂ ਬੈਠ ਜਾਂਦੇ ਹੈ ਘੋੜਾ ਜਦੋਂ ਆਪਣੀ ਸਪੀਡ ਦੇ ਨਾਲ ਚੱਲਦਾ ਤਾਂ ਬਹੁਤ ਤਕਲੀਫ ਹੁੰਦੀ ਹੈ ਅਤੇ ਮੈਂ ਇਹੀ ਕਹਾਂਗਾ ਕਿ ਜਿਹੜਾ ਮੇਰਾ ਅਨੁਭਵ ਹੈ ਵੀ ਉਹਦੇ ਉੱਤੇ ਬੈਠਣ ਤੋਂ ਪਹਿਲਾਂ ਕਾਠੀ ਵੀ ਵਰਤੋਂ ਜ਼ਰੂਰ ਕਰ ਲੈਣੀ ਚਾਹੀਦੀ ਹੈ